ਸਕੂਲਾਂ ਵਿੱਚ ਅਧਿਆਪਿਕਾ ਨੂੰ ਪੜ੍ਹਾਉਣ ਲਈ ਕਿਹੜੀ ਚੀਜ਼ਾਂ ਦੀ ਲੋੜ ਹੈ ਸਕੂਲਾਂ ਵਿੱਚ ਕਿਹੜੀ ਚੀਜ਼ਾਂ ਦੀ ਕਮੀ ਹੈ ਸਕੂਲਾਂ ਵਿੱਚ ਅਧਿਆਪਿਕਾਵਾਂ ਨੂੰ ਪੜ੍ਹਾਉਣ ਲਈ ਬਹੁਤ ਚੀਜ਼ਾਂ ਦੀ ਲੋੜ ਪੈਂਦੀ ਹੈ ਸਭ ਤੋਂ ਪਹਿਲਾਂ ਉਹਨਾਂ ਦੇ ਅੰਦਰ ਇੰਨੀ ਸ਼ਕਤੀ ਹੋਣੀ ਚਾਹੀਦੀ ਕਿ ਉਹ ਤੀਹ ਚਾਲ੍ਹੀ ਪੰਜਾਹ ਲੋਕਾਂ ਦੇ ਸਾਹਮਣੇ ਸੋਰੀ ਤੀਹ ਚਾਲ੍ਹੀ ਪੰਜਾਹ ਬੱਚਿਆਂਵਾਂ ਦੇ ਸਾਹਮਣੇ ਜਾ ਕੇ ਬੋਲ ਪਾਉਣ ਕਿਉਂਕਿ ਬੱਚੇ ਜੋ ਹੁੰਦੇ ਹਨ ਬਹੁਤ ਹੀ ਸ਼ਰਾਰਤੀ ਕਿਸਮ ਦੇ ਹੁੰਦੇ ਹਨ ਉਹ ਬੋਲਦੇ ਬੋਲਦੇ ਟੋਕ ਦਿੰਦੇ ਹਨ ਅਤੇ ਅਗਰ ਟੀਚਰ ਕਮਜ਼ੋਰ ਦਿਲ ਦਾ ਹੈ ਜਾਂ ਨਹੀਂ ਬੋਲ ਪਾ ਰਿਹਾ ਉਹਨਾਂ ਸਾਹਮਣੇ ਤਾਂ ਟੀਚਰ ਨੂੰ ਉਸ ਚੀਜ਼ ਦੀ ਬਹੁਤ ਜ਼ਰੂਰਤ ਹੈ ਕਿਉਂਕਿ ਅਗਰ ਟੀਚਰ ਨਹੀਂ ਬੋਲ ਪਾਏਗਾ ਕਿਉਂਕਿ ਬੱਚੇ ਤਾਂ ਸ਼ਰਾਰਤੀ ਹੁੰਦੇ ਉਹ ਪੜ੍ਹਨਾ ਨਹੀਂ ਚਾਹੁੰਦੇ ਆ ਤਾਂ ਕਿ ਉਹ ਬਚ ਜਾਣਗੇ ਅਤੇ ਉਹ ਨਹੀਂ ਪੜ੍ਹ ਪਾਓਣਗੇ ਅਤੇ ਜੇ ਜੋ ਉਹਨਾਂ ਦੀ ਗਰੋਥ ਵਿੱਚ ਅੱਗੇ ਵਧਣ ਵਿੱਚ ਉਹਨਾਂ ਨੂੰ ਕਮੀ ਪਾਵੇਗਾ ਅਤੇ ਉਸ ਤੋਂ ਬਾਅਦ ਅਗਰ ਟੀਚਰ ਬੋਲ ਵੀ ਪਾਇਆ ਟੀਚਰ ਨੂੰ ਥੋੜ੍ਹਾ ਗੁੱਸੇ ਵਾਲਾ ਵੀ ਹੋਣਾ ਚਾਹੀਦਾ ਟੀਚਰ ਨੂੰ ਇੱਕਦਮ ਫਰੈਂਡਲੀ ਟਾਈਪ ਦਾ ਨਹੀਂ ਹੋਣਾ ਚਾਹੀਦਾ ਹੈ ਟੀਚਰ ਅਗਰ ਥੋੜ੍ਹਾ ਗੁੱਸੇ ਵਾਲਾ ਹੋਵੇਗਾ ਤਾਂ ਬੱਚੇ ਉਹ ਤੋਂ ਥੋੜ੍ਹਾ ਡਰ ਕੇ ਰਹੂਗੇ ਅਗਰ ਥੋੜ੍ਹਾ ਡਰ ਕੇ ਰਹੂਗੇ ਅਤੇ ਉਹ ਟੀਚਰ ਦੀ ਹਮੇਸ਼ਾਂ ਹੀ ਇੱਜ਼ਤ ਕਰੁਗੇ ਉਹਨੂੰ ਹਮੇਸ਼ਾਂ ਹੀ ਪੜਾ ਸਮਾਨ ਦਉਗੇ ਅਤੇ ਅਗਰ ਸ ਉਸ ਤਰ੍ਹਾਂ ਗੱਲ ਕੀਤੀ ਜਾਵੇ ਤਾਂ ਟੀਚਰ ਨੂੰ ਇੱਕ ਚੋਕ ਦੀ ਲੋੜ ਹੈ ਲਿਖਣ ਦੇ ਲਈ ਅਤੇ ਇੱਕ ਡਸਟਰ ਦੀ ਲੋੜ ਹੈ ਰਬ ਕਰਨ ਦੇ ਲਈ ਜਾਂ ਹਟਾਉਣ ਦੇ ਲਈ ਜੋ ਉਹਨੇ ਲਿਖਿਆ ਹੋਵੇ ਅਤੇ ਇੱਕ ਬਲੈਕਬੋਰਡ ਦੀ ਲੋੜ ਹੈ ਜਿੱਥੇ ਉਹ ਲਿਖ ਸਕਦਾ ਅਤੇ ਅਗਰ ਇਹ ਛੋਟੇ ਬੱਚਿਆਂ ਦੀ ਕਲਾਸ ਤੱਕ ਸਹੀ ਹੈ ਪਰ ਅਗਰ ਤੁਸੀਂ ਵੱਡੇ ਬੱਚਿਆਂ ਦੀ ਕਲਾਸ 'ਚ ਆ ਜਾਂਦੇ ਓਂ ਉੱਥੇ ਬਹੁਤ ਹੀ ਮੁਸ਼ਕਿਲ ਮੁਸ਼ਕਿਲ ਸਮਾ ਸਵਾਲ ਕੱਢਣੇ ਹੁੰਦੇ ਹਨ ਬਹੁਤ ਹੀ ਮੁਸ਼ਕਿਲ ਮੁਸ਼ਕਿਲ ਡਾਇਗ੍ਰਾਮਾਂ ਹੁੰਦੀਆਂ ਹਨ ਅਤੇ ਟੀਚਰ ਬਹੁਤ ਵਧੀਆ ਉਹ ਨਹੀਂ ਹੋ ਸਕਦਾ ਲਾਈਕ ਦੁਬਾਰਾ ਨਹੀਂ ਹੋ ਸਕਦਾ ਅਗਰ ਉਹ ਬਹੁਤ ਵਧੀਆ ਟੀਚਰ ਹੈ ਅਗਰ ਮੰਨ ਲਓ ਹੈਗਾ ਵੀ ਬਹੁਤ ਵਧੀਆ ਡਰਾਇੰਗ ਕਰ ਲੈਂਦਾ ਆ ਅਤੇ ਉਹਦੇ ਵਿੱਚ ਉਹਦਾ ਬਹੁਤ ਸਮਾਂ ਚਲਾ ਜਾਵੇਗਾ ਅਤੇ ਉਹਦਾ ਪੜ੍ਹਾਉਣ ਦਾ ਸਮਾਂ ਜਿਹੜਾ ਹੈ ਉਹ ਖਤਮ ਹੋ ਜਾਏਗਾ ਅਤੇ ਅਗਰ ਉਹ ਬਹੁਤ ਵਧੀਆ ਡਿਜ਼ਾਇਨ ਸਮੇਂ ਵਿੱਚ ਬਣਾ ਵੀ ਲੈਂਦਾ ਅਤੇ ਫਿਰ ਇਹ ਪੱਕਾ ਨਹੀਂ ਹੁੰਦਾ ਕਿ ਜਿਹੜਾ ਬੱਚਾ ਹੈ ਉਸ ਨੂੰ ਸਮਝ ਪਵੇਗਾ ਕਿਉਂਕਿ ਬੱਚੇ ਨੂੰ ਉਹ ਡਾਇ ਡਾਇਗ੍ਰਾਮ ਪਹਿਲੀ ਵਾਰੀ ਦੇਖੀ ਹੋਏਗੀ ਟੀਚਰ ਤੋਂ ਬਹੁਤ ਹੀ ਵਾਰ ਦੇਖਿਆ ਹੋਗਾ ਟੀਚਰ ਵੱਲੋਂ ਤੋਂ ਬਹੁਤ ਸਹੀ ਡਾਇਗ੍ਰਾਮ ਆ ਪਰ ਬੱਚਾ ਉਹਨੂੰ ਨਹੀਂ ਸਮਝ ਪਾਏਗਾ ਕਿਉਂਕਿ ਉਹ ਪੂਰੀ ਸਫੇਦ ਰੰਗ ਵਿੱਚ ਡਾਇਗ੍ਰਾਮ ਹੋ ਗਈ ਕਿਉਂਕਿ ਇੱਕ ਕਲਰ ਦਾ ਚੌਕ ਹੁੰਦਾ ਆ ਅਤੇ ਇਸ ਕਰਕੇ ਟੀਚਰਸ ਨੂੰ ਚਾਹੀਦਾ ਕਿ ਉਹ ਇੱਕ ਸਮਾਰਟ ਕਲਾਸਿਸ ਬਣਾਉਣ ਜਿਹਦੇ ਵਿੱਚ ਉਹਨਾਂ ਦਾ ਸਮੇਂ ਬਚੇਗਾ ਉਹਨਾਂ ਨੂੰ ਬਸ ਇੱਕ ਫਾਈਲ ਡਾਊਨਲੋਡ ਕਰਨੀ ਹੈ ਜਾਂ ਫਾਈਲ ਔਨਲਾਈਨ ਹੀ ਦਿਖਾ ਦੇਣ ਜਿਹਦੇ ਵਿੱਚ ਉਹ ਦੇਖ ਸਕਦੇ ਆ ਕਿ ਵੱਖਰੇ ਵੱਖਰੇ ਰੰਗਾਂ ਵਿੱਚ ਹੋਏਗਾ ਹੋਰ ਜ਼ਿਆਦਾ ਡਿਟੇਲਡ ਹੋਵੇਗਾ ਅਤੇ ਹਰ ਇੱਕ ਚੀਜ਼ ਨੂੰ ਬਹੁਤ ਬਰੀਕੀ ਨਾਲ ਦੱਸਿਆ ਜਾਂਦਾ ਹੈ ਜਿਹਦੇ ਵਿੱਚ ਬੱਚਿਆਂ ਨੂੰ ਸਮਝਣ ਨੂੰ ਬਹੁਤ ਮਦਦ ਹੋਵੇਗੀ ਇਸ ਨਾਲ ਬੱਚੇ ਜਿਹੜੇ ਹੈ ਹਮੇਸ਼ਾਂ ਹੀ ਉਤਸੁਕ ਰਹਿਣਗੇ ਅਤੇ ਸਿੱਖਣ ਦੀ ਕੋਸ਼ਿਸ਼ ਕਰਨਗੇ ਧੰਨਵਾਦ